ਅਸੀਂ ਪੰਜਾਬ ਸੂਬੇ ਵਿੱਚ ਰਹਿਦੇ ਹਾਂ ਅਸੀਂ ਪੰਜਾਬੀ ਬੋਲਦੇ ਹਾਂ ਪੰਜਾਬੀ ਲਿਖਦੇ ਹਾਂ ਪੰਜਾਬੀ ਪੜ੍ਹਦੇ ਹਾਂ ਜੋ ਆਪਣੀ ਮਾਤ ਭਾਸ਼ਾ ਉਸ ਨੂੰ ਅਸੀਂ ਸੌਖੀ ਤਰ੍ਹਾਂ ਸਿੱਖ ਸਕਦੇ ਹਾਂ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਕੀ ਚੱਲਦਾ ਹੈ ਵੀ ਬੱਚਿਆਂ ਨੂੰ ਸ਼ੁਰੂ ਤੋਂ ਹੀ ਇੰਗਲਿਸ਼ ਪੜ੍ਹਾਈ ਜਾਂਦੀ ਹੈ ਆਪਣੀ ਮਾਤ ਭਾਸ਼ਾ ਨੂੰ ਤੋੜ ਦਿੱਤਾ ਜਾਂਦਾ ਹੈ ਜੋ ਬੱਚਾ ਹੁੰਦਾ ਉਹ ਮਾਤ ਭਾਸ਼ਾ ਜਲਦੀ ਸਿੱਖਦਾ ਕਿਉਂਕਿ ਆਪਾਂ ਘਰਾਂ ਦੇ ਵਿੱਚ ਵੀ ਪੰਜਾਬੀ ਬੋਲਦੇ ਹਾਂ ਬੱਚੇ ਪੰਜਾਬੀ ਦਾ ਹੀ ਸਾਰਾ ਕੁਛ ਦੇਖਦੇ ਹੈ ਇਸ ਕਰਕੇ ਉਹਨਾਂ ਨੂੰ ਇੰਗਲਿਸ਼ ਔਖੀ ਵੀ ਲੱਗਦੀ ਹੈ ਪਰ ਸਕੂਲਾਂ ਦੇ ਵਿੱਚ ਫਾਈਨ ਲਾ ਦਿੰਦੇ ਹੈ ਵੀ ਬੱਚਿਆਂ ਨੂੰ ਨਹੀਂ ਬੋਲਣ ਦਿੱਤਾ ਜਾਂਦਾ ਇਸ ਕਰਕੇ ਵੀ ਪੰਜਾਬੀ ਭਾਸ਼ਾ 'ਤੇ ਹੀ ਸਾਨੂੰ ਜ਼ੋਰ ਦੇਣਾ ਚਾਹੀਦਾ ਹੈ ਜੇ ਹੁਣ ਤੁਸੀਂ ਦੇਖੋ ਵੀ ਦਫ਼ਤਰਾਂ ਦੇ ਵਿੱਚ ਜਾਓ ਸਾਰੇ ਅਫਸਰ ਅੰਗਰੇਜ਼ੀ 'ਚ ਲਿਖਦੇ ਹੈ ਇੱਕ ਅਨਪੜ੍ਹ ਬੰਦਾ ਕੋਈ ਕੰਮ ਕਰਵਾਉਣ ਵਾਸਤੇ ਜਾਂਦਾ ਉਹ ਸੋਚਦਾ ਵੀ ਹੁਣੇ ਪਤਾ ਨੀ ਇੱਥੇ ਕੀ ਲਿਖਿਆ ਨਾ ਉਹ ਮੁੜ ਕੇ ਅਫਸਰ ਨੂੰ ਪੁੱਛ ਸਕਦਾ ਹੁੰਦਾ ਵੀ ਤੁਸੀਂ ਕੀ ਲਿਖਿਆ ਇਸ ਕਰਕੇ ਉਹ ਵਿਚਾਰੇ ਭੰਬਲ ਭੁੱਸੇ 'ਚ ਹੀ ਪਏ ਰਹਿੰਦੇ ਹੈ ਇਸ ਕਰਕੇ ਸਾਨੂੰ ਵੀ ਆਪਣੀ ਮਾਤ ਭਾਸ਼ਾ ਜਿਹੜੀ ਪੰਜਾਬੀ ਉਹ ਹੀ ਬੋਲਣੀ ਚਾਹੀਦੀ ਹੈ ਦਫ਼ਤਰਾਂ ਦੇ ਵਿੱਚ ਵੀ ਲਾਗੂ ਹੋਣੀ ਚਾਹੀਦੀ ਹੈ ਜਾਂ ਜਿਵੇਂ ਸਾਈਨ ਬੋਰਡ ਲੱਗੇ ਹੁੰਦੇ ਆ ਆਪਣੇ ਉਹ ਇੰਗਲਿਸ਼ ਦੇ ਵਿੱਚ ਲਿਖ ਦਿੰਦੇ ਆ ਇੱਕ ਘੱਟ ਪੜ੍ਹਿਆ ਲਿਖਿਆ ਬੰਦਾ ਜਿਹੜਾ ਉਹ ਉਸਨੂੰ ਕਿਵੇਂ ਪੜੂਗਾ ਜੇ ਪੰਜਾਬੀ ਦੇ ਵਿੱਚ ਹੋਊਗਾ ਉਹ ਉਹਨੂੰ ਸੌਖਿਆਂ ਪੜਲੂਗਾ ਇਸ ਕਰਕੇ ਵੀ ਪੰਜਾਬ ਦੇ ਵਿੱਚ ਖ਼ਾਸ ਕਰ ਪੰਜਾਬੀ ਭਾਸ਼ਾ ਦਾ ਹੀ ਮਤਲਬ ਹੋਣਾ ਚਾਹੀਦਾ ਜ਼ਿਆਦਾ ਪਰ ਇੱਥੇ ਕੀ ਚੱਲਦਾ ਪੰਜਾਬੀ ਤਾਂ ਪਿੱਛੇ ਛੱਡ ਦਿੱਤੀ ਜਾਂਦੀ ਹੈ ਜਾਂ ਲੰਘੜੀ ਲੂਲੀ ਲਿਖੀ ਜਾਂਦੀ ਹੈ ਅਤੇ ਇੰਗਲਿਸ਼ 'ਤੇ ਹੀ ਜ਼ੋਰ ਦਿੱਤਾ ਜਾਂਦਾ ਇਸ ਕਰਕੇ ਕਹਿੰਦੇ ਹਾਂ ਵੀ ਪੰਜਾਬੀ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਆਪਣੀ ਮਾਤ ਭਾਸ਼ਾ ਹੀ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਉੱਦੋਂ ਮਗਰੋਂ ਜਦੋਂ ਵੱਡੇ ਹੋ ਜਾਂਦੇ ਬੱਚੇ ਤੁਸੀਂ ਜਿੰਨਾ ਮਰਜ਼ੀ ਕੋਈ ਭਾਸ਼ਾ ਸਿਖਾ ਲਓ ਬੱਚੇ ਸਿੱਖ ਜਾਣਗੇ ਸੌਖਿਆਂ ਪਰ ਪਹਿਲਾਂ ਉਹ ਪੰਜਾਬੀ ਭਾਸ਼ਾ ਹੀ ਸਹੀ ਸਿੱਖਣਗੇ ਇਸ ਕਰਕੇ ਪੰਜਾਬੀ ਪੜ੍ਹਨੀ ਚਾਹੀਦੀ ਹੈ ਪੰਜਾਬੀ ਲਿਖਣੀ ਚਾਹੀਦੀ ਹੈ ਪੰਜਾਬੀ ਬੋਲਣੀ ਚਾਹੀਦੀ ਹੈ ਸਾਡਾ ਇਤਿਹਾਸ ਬਹੁਤ ਵਧੀਆ ਲਿਖਿਆ ਵਾ ਪੰਜਾਬੀ ਦੇ ਵਿੱਚ ਜਾਂ ਜਿਵੇਂ ਗੁਰੂ ਨਾਨਕ ਦੇਵ ਜੀ ਬਾਬਾ ਫਰੀਦ ਹੈ ਸੂਫੀ ਕਵੀ ਹੈ ਅੰਮ੍ਰਿਤਾ ਪ੍ਰੀਤਮ ਵਰਗਿਆਂ ਨੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਸਹਿਤ ਲਿਖਿਆ ਇਸ ਕਰਕੇ ਪੰਜਾਬੀ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਆਪਣੀ ਮਾਤ ਭਾਸ਼ਾ ਨੂੰ ਕਾਇਮ ਰੱਖਣਾ ਚਾਹੀਦਾ